ਬਿਜਲੀ ਦੇ ਕੱਟ ਹੁਣ ਤੇ ਬਹੁਤ ਘੱਟ ਲੱਗਦੇ ਨੇ ਜਦੋਂ ਪਹਿਲੇ ਬੜੇ ਸਾਲ ਪਹਿਲੇ ਦੁਪਹਿਰੇ ਤਿੰਨ ਵਜੇ ਬਿਜਲੀ ਜਾਣੀ ਗਰਮੀਆਂ ਚ ਤੇ ਰਾਤ ਨੂੰ ਆਣੀ ਤੇ ਉਦੋਂ ਇਨਵਾਟਰ ਵੀ ਕੋਈ ਕੰਮ ਨਹੀਂ ਕਰਦੇ ਸੀ ਕੁਝ ਘੰਟੇ ਚੱਲੇ ਤੇ ਜੇ ਰਾਤ ਨੂੰ ਬਿਜਲੀ ਚਲ ਜਾਂਦੀ ਸੀ ਤੇ ਫਿਰ ਕੋਠਿਆਂ ਤੇ ਜਾਣਾ ਤੇ ਮੱਛਰਾਂ ਦੇ ਵਿੱਚ ਸਾਰੀ ਰਾਤ ਕੱਢ ਕੱਢ ਕੇ ਬੁਰਾ ਹਾਲ ਹੋ ਜਾਂਦਾ ਸੀ ਹੁਣ ਉਹ ਸਰਦੀਆਂ ਦੇ ਵਿੱਚ ਤੇ ਬਹੁਤ ਵਧੀਆ ਚਲ ਵੀ ਜਾਏ ਬਿਜਲੀ ਦਾ ਕੋਈ ਇਨਾ ਪਤਾ ਨਹੀਂ ਚਲਦਾ ਤੇ ਗਰਮੀਆਂ ਚ ਹੁਣ ਕੱਟ ਹੀ ਜਾਂਦੀ ਹ ਅਗਰ ਜਦੋਂ ਵੀ ਚਲ ਜਾਵੇ ਤੇ ਬਹੁਤ ਔਖਾ ਹੁੰਦਾ ਸੁੱਤੇ ਸੁੱਤੇ ਬੰਦੇ ਨੂੰ ਪਸੀਨੋ ਪਸੀਨ ਸਾਰੀ ਰਾਤ ਇੱਦਾ ਈ ਕੱਢ ਦੋ ਤੇ ਜੇ ਸਵੇਰੇ ਚਲ ਜਾਏ ਬਹੁਤ ਔਖਾ ਕਿਸੇ ਵੇਲੇ ਤੇ ਇਦਾਂ ਹੁੰਦਾ ਕੱਪੜੇ ਮਸ਼ੀਨ ਚ ਚਲਦੇ ਹੁੰਦੇ ਨੇ ਤੇ ਲਾਈਟ ਚਲ ਜਾਂਦੀ ਹ ਤੇ ਕੋਈ ਪਤਾ ਹੀ ਨਹੀਂ ਸਾਰਾ ਸਾਰਾ ਦਿਨ ਆਣੀ ਹ ਕਿ ਨਹੀਂ ਆਣੀ ਹੁਣ ਫਿਰ ਵੀ ਬੜਾ ਫਰਕ ਹ ਹੁਣ ਅਗੋ ਦੇਖੋ ਗਰਮੀਆਂ ਚ ਕੀ ਹਾਲ ਨੇ ਇੰਡੀਆ ਦੇ ਪਰ ਫਿਰ ਵੀ ਅੱਗੋਂ ਨਾਲੋਂ ਇੰਡੀਆ ਨੇ ਕਾਫੀ ਤਰੱਕੀ ਕਰ ਲਈ ਹ ਕਾਫੀ ਦੇਸ਼ ਨੇ ਸਾਡੇ ਪੰਜਾਬ ਨੇ ਬਹੁਤ ਵਧੀਆ ਹੋ ਗਿਆ ਕਿ ਹੁਣ ਸਾਨੂੰ ਬਿਜਲੀ ਬਥੇਰੇ ਘੰਟੇ ਮਿਲਦੀ ਏ ਕਦੀ ਹੋ ਗਿਆ ਤੇ ਗਰਮੀਆਂ ਚ ਅੱਧਾ ਘੰਟਾ ਚੱਲ ਗਈ ਤੇ ਕਦੀ ਕਦੀ ਇਨੇ ਘ ਇੇਨੇ ਦਿਨ ਬੀਤ ਜਾਂਦੇ ਨੇ ਕਦੀ ਜਾਂਦੀ ਨਹੀਂ ਸਾਰਾ ਸਾਰਾ ਦਿਨ ਬਿਜਲੀ ਰਹੇਗੀ ਐਹ ਹੁਣ ਅੱਗੇ ਨਾਲੋਂ ਬਹੁਤ ਵਧੀਆ ਕੰਮ ਹੋ ਗਿਆ ਅੱਗੇ ਅੱਗੇ ਅਸੀਂ ਸੈਂਕ ਤੇ ਰਹਿਣਾ ਕਿ ਟੀਵੀ ਦੇਖਣਾ ਲਾਈਟ ਆਏਗੀ ਕਦੋਂ ਏਸੀ ਚਲਾਵਾਂਗੇ ਕਦੋਂ ਧੰਨਵਾਦ ਜੀ